ਡੋਂਟ ਵਰੀ ਸੋਸ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਜੀ ਤੁਸੀਂ ਬਸ ਆਵਾਜ਼ ਆਉਂਦੀ ਹੈ ਜੀ ਮੇਰੀ ਆਵਾਜ਼ ਨਹੀਂ ਆਉਂਦੀ ਮੇਰੀ ਹਾਂਜੀ ਹਾਂਜੀ ਹੋਰ ਬੱਚੇ ਠੀਕ ਆ ਮ ਬੱਚੇ ਠੀਕ ਨਹੀਂ ਅੱਛਾ ਇੱਕ ਤਾਂ ਮੰਡੇ ਨੂੰ ਇੱਥੇ ਸੈਵਨਟੀ ਏਟ 'ਚ ਮੰਡੀ ਲੱਗਦੀ ਹੈ ਜੀ ਸਬਜ਼ੀ ਦੀ ਅਤੇ ਫਰਾਈਡੇ ਨੂੰ ਲੱਗਦੀ ਹੈ ਸੈ ਸੈਵਨਟੀ ਸਿਕਸਟੀ ਏਟ ਦੇ ਵਿੱਚ ਜੀ ਜਿੱਥੇ ਆਪਣਾ ਵਿਜੀਲੈਂਸ ਦਾ ਦਫਤਰ ਹੈ ਸਿਕਸਟੀ ਏਟ ਦੇ ਵਿੱਚ ਅਤੇ ਬੈ ਬੈ ਹਾਂਜੀ ਸਭ ਕੁਛ ਮਿਲਦਾ ਫਰੂਟ ਵੀ ਬਹੁਤ ਵਧੀਆ ਮਿਲਦਾ ਹੈ ਜੀ ਅਤੇ ਵੈਡਨਸਡੇ ਨੂੰ ਲੱਗਦੀ ਹੈ ਸੈ ਸੈਕ ਫੇਸ ਸੈਵਨ ਵਿੱਚ ਸੱਤ ਫੇਸ ਦੇ ਵਿੱਚ ਭਾਵੇਂ ਸਬਜ਼ੀ ਲਓ ਭਾਵੇਂ ਲਓ ਆਪਣਾ ਦੂਜਾ ਫਰੂਟ ਅਤੇ ਆਮ ਕਰਕੇ ਜੇ ਰੇੜੀਆਂ ਰੂੜੀਆਂ 'ਤੇ ਘੱਟ ਹੀ ਲਿਆ ਕਰੋ ਜੀ ਕਿਉਂਕਿ ਵੈਸੇ ਇੱਕ ਫੇਸ ਤੁਹਾਨੂੰ ਦੂਰ ਪੈ ਜਾਣਾ ਇੱਕ ਹਾਂਜੀ ਹਾਂਜੀ ਹਾਂਜੀ ਇਕ ਕਿਸਾਨ ਇਹ ਕਿਸਾਨ ਮੰਡੀਆਂ ਲੱਗਦੀਆਂ ਜੀ ਆਮ ਕਰਕੇ ਬਾਕੀ ਹਾਂ ਬਾਕੀ ਕੋਈ ਗੱਲ ਨਹੀਂ ਫੋਨ 'ਤੇ ਤੁਹਾਨੂੰ ਦੱਸ ਦੇਵਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ